ਸਾਡੇ ਇਲਾਕੇ ਵਿੱਚ ਵਿਆਹ ਤੋਂ ਪਹਿਲਾਂ ਬਹੁਤ ਸਾਰੀਆਂ ਰਸਮਾਂ ਮਨਾਈਆਂ ਜਾਂਦੀਆਂ ਹਨ ਜਿਵੇਂ ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਦਾ ਸੰਗੀਤ ਹੁੰਦਾ ਹੈ ਹਲਦੀ ਹੁੰਦੀ ਹੈ ਅਤੇ ਇਹਨਾਂ ਵਿੱਚ ਗਿੱਧਾ ਨਾਚ ਗਾਣਾ ਵੀ ਹੁੰਦਾ ਹੈ ਠੀਕ ਹੈ ਇਹਨਾਂ ਨੂੰ ਬਾਹਰ ਸੈਲਾਨੀ ਵੀ ਦੇਖਣ ਆ ਸਕਦੇ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਮਨੋਰੰਜਕ ਹੁੰਦਾ ਹੈ ਅਗਰ ਆਪਾਂ ਪਿੰਡ ਵਿੱਚ ਜਾਈਏ ਤਾਂ ਆਪਾਂ ਨੂੰ ਧੂਮਧਾਮ ਨਾਲ ਵਿਆਹ ਮਨਾਇਆ ਦਿਖੇਗਾ ਅਗਰ ਉਹ ਆਪਾਂ ਉਹਨਾਂ ਦੀਆਂ ਰਸਮਾਂ ਰੀਤਾਂ ਨੂੰ ਦੇਖਦੇ ਹਾਂ ਤਾਂ ਆਪਣਾ ਬਹੁਤ ਮਨ ਲੱਗਦਾ ਹੈ ਆਪਾਂ ਪੁਰਾਣੇ ਜ਼ਮਾਨੇ ਅਨੁਸਾਰ ਗਾਣਾ ਗਾਉਦੇ ਹਾਂ ਢੋਲਕੀ ਵਜਾਉਂਦੇ ਹਾਂ ਅਤੇ ਇਹਨਾਂ ਸਾਰੀਆਂ ਰਸਮਾਂ ਵਿੱਚ ਖੂਬ ਬਣ ਠਣ ਕੇ ਹਿੱਸਾ ਲੈਂਦੇ ਹਾਂ ਇਸ ਤਰ੍ਹਾਂ ਸੈਲਾਨੀਆਂ ਨੂੰ ਵੀ ਆਪਣੀਆਂ ਰਸਮਾਂ ਵਿੱਚ ਹਿੱਸਾ ਬਣਨ ਦੀ ਇਜਾਜ਼ਤ ਹੈ